ਜੀ ਹਾਂ ਅਸੀਂ ਮੱਧ ਪੀੜ੍ਹੀ ਦਾ ਉਹ ਹਿੱਸਾ ਹਾਂ ਜੋ ਕਿ ਪੁਰਾਣੀ ਪੀੜ੍ਹੀ ਅਤੇ ਨੌਜਵਾਨ ਪੀੜ੍ਹੀ ਵਿਚਕਾਰ ਸੰਤੁਲਨ ਦਾ ਪ੍ਰਬੰਧਨ ਜੇ ਕੋਸ਼ਿਸ਼ ਕਰਦੀ ਹੈ ਇਹ ਅਸਲ ਵਿੱਚ ਤਾਂ ਮੱਧ ਪੀ ਪੀੜ੍ਹੀ ਵਾਲੇ ਵਿਅਕਤੀ ਜੋ ਹੁੰਦੇ ਨੇ ਉਹ ਦੋ ਪ੍ਰਕਾਰ ਦੇ ਵੱਖ ਵੱਖ ਸੰਸਾਰ ਆਪਣੀ ਜ਼ਿੰਦਗੀ ਵਿੱਚ ਜਿਉਂਦੇ ਹਨ ਜਿਹਨਾਂ ਵਿੱਚੋਂ ਪੁਰਾਣੀ ਪੀੜ੍ਹੀ ਦੀ ਐਥਿਕਸ ਐਂਡ ਮੋਰਲ ਵੈਲਿਊਜ ਵੀ ਹੋਣੀਆਂ ਚਾਹੀਦੀਆਂ ਹਨ ਅਤੇ ਹਰ ਇੱਕ ਪਰਸਨ ਦੇ ਵਿੱਚ ਇਮੋਸ਼ਨਲ ਸਟਰੈਂਥ ਹੋਣੀ ਚਾਹੀਦੀ ਆ ਮੀਨਸ ਵੀ ਲਾਈਕ ਉਹ ਆਪਣੇ ਆਪ ਨੂੰ ਆਪਣੀਆਂ ਪੁਰਾਣੀਆਂ ਵੈਲਿਊਜ ਦੇ ਨਾਲ ਜੋੜ ਕੇ ਵੀ ਰੱਖਣਾ ਚਾਹੁੰਦੇ ਹਨ ਅਤੇ ਕਿਸੇ ਕਿਸੇ ਇਹੋ ਜਿਹੇ ਮੌਕੇ ਅਵਸਰ ਉੱਤੇ ਉਹ ਆਪਣੀ ਜ਼ਿੰਦਗੀ ਵਿੱਚ ਨਵੇਂ ਚੇਂਜਿਜ਼ ਵੀ ਚਾਹੁੰਦੇ ਹਨ ਜਿਵੇਂ ਕਿ ਅੱਜ ਕੱਲ੍ਹ ਦੇ ਲੋਕ ਅਰਬਨ ਕਲਚਰ ਵੱਲ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਅਤੇ ਉਹ ਆਪਣੇ ਅਰਬਨ ਕਲਚਰ ਵਿੱਚ ਜਾਣਾ ਚਾਹੁੰਦੇ ਹਨ ਪਰ ਕੁਝ ਲੋਕ ਅਜਿਹੇ ਹਨ ਜੋ ਕਿ ਆਪਣੀ ਮੱਧ ਪੀੜ੍ਹੀ ਦੇ ਅਕੋਡਿੰਗ ਪੁਰਾਣੀ ਪੀੜ੍ਹੀ ਅਤੇ ਨੌਜਵਾਨ ਪੀੜ੍ਹੀ ਦੋਹਾਂ ਦੇ ਸੰਤੁਲਨ ਨੂੰ ਚਾਹੁੰਦੇ ਹਨ ਅਤੇ ਇੱਥੇ ਵੱਖ ਵੱਖ ਪ੍ਰਕਾਰ ਦੀਆਂ ਸਮਾਨਤਾਵਾਂ ਅਤੇ ਅੰਤਰ ਹਨ ਜੋ ਕਿ ਆਪਣੇ ਅਨੁਭਵ ਬਾਰੇ ਦੱਸਣਾ ਚਾਹੁੰਦੇ ਹਾਂ ਜਿਵੇਂ ਕਿ ਹੁਣ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਪੁਰਾਣੀ ਪੀੜ੍ਹੀ ਦੇ ਮੁਤਾਬਿਕ ਲੋਕਾਂ ਦੀ ਰਿਸਪੈਕਟ ਕਰਨੀ ਅਤੇ ਉਹਨਾਂ ਦੇ ਪਿਆਰ ਸਤਿਕਾਰ ਦੀ ਵੈਲਿਊ ਕਰਨੀ ਚਾਹੀਦੀ ਆ ਅਤੇ ਮੈਂ ਨੌਜਵਾਨ ਪੀੜ੍ਹੀ ਦੇ ਮੁਤਾਬਿਕ ਮੈਨੂੰ ਨਵਾਂ ਕਲਚਰ ਨਵਾਂ ਮਿਊਜ਼ਿਕ ਵੀ ਪਸੰਦ ਹੈ ਸੋ ਇਸ ਪ੍ਰਕਾਰ ਇੱਥੇ ਬਹੁਤ ਹੀ ਪ੍ਰਕਾਰ ਦੇ ਅੰਤਰ ਹਨ ਜਿਸ ਵਿੱਚ ਸੰਭਾਲਣ ਦੇ ਅਨੁਭਵ ਮੈਨੂੰ ਬਹੁਤ ਹੀ ਵਧੀਆ ਲੱਗਦੇ ਹਨ